ਹਾਂ ਮੈਂ ਇਵੇਂ ਸੋਚਦੀ ਹਾਂ ਕਿ ਮੇਰੀ ਪੇਟਿੰਗਾਂ ਵਿੱਚ ਦੂਜਿਆਂ ਨੂੰ ਪ੍ਰਭਾਵਿਤ ਕਰਨ ਅਤੇ ਪ੍ਰਭਾਵਿਤ ਕਰਨ ਦੀ ਸ਼ਕਤੀ ਹੈ ਮੈਂ ਇੱਕ ਜਾਗਰੂਕਤ ਪੇਂਟਿੰਕ ਪੇਂਟਿੰਗਜ਼ ਬਣਾਉਂਦੀ ਹਾਂ ਜਿਸ ਦਾ ਮੇਨ ਮੁੱਦਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੇ ਉਹ ਪ੍ਰਦੂਸ਼ਣ ਦੇ ਨਾਲ ਸੰਬੰਧਿਤ ਹੋਵੇ ਚਾਹੇ ਕੋਈ ਹੋਰ ਸਮਾਜਿਕ ਕੁਰੀਤੀਆਂ ਨਾਲ ਸੰਬੰਧਿਤ ਹੋਵੇ ਮੇਰਾ ਸਭ ਤੋਂ ਵੱਡਾ ਮੋਟਿਵ ਇਹ ਹੁੰਦਾ ਹੈ ਕਿ ਮੈਂ ਉਹਨਾਂ ਨੂੰ ਪ੍ਰਭਾਵਿਤ ਕਰਨਾ ਤਾਂ ਕਿ ਉਹ ਸਹੀ ਫੈਸਲਾ ਲੈਣ ਔਰ ਸਹੀ ਰਾਸਤੇ 'ਤੇ ਚੱਲਣ